ਮੈਂ ਸਕੂਲ ਦੇ ਵਿੱਚ ਵਿਗਿਆਨ ਅਤੇ ਗਣਿਤ ਪੜ੍ਹਿਆ ਹੈ ਅਤੇ ਇਹ ਬਹੁਤ ਹੀ ਅਪੋਰਟੈਂਟ ਸਬਜੈਕਟ ਹੈ ਵਿਗਿਆਨ ਵਿੱਚ ਮੈਂ ਬਹੁਤ ਸਾਡੇ ਸਕੂਲ 'ਚ ਵਿਗਿਆਨ ਵਾਲੇ ਟੀਚਰ ਬਹੁਤ ਵਧੀਆ ਜੋ ਸਾਨੂੰ ਬਹੁਤ ਵਧੀਆ ਸਮਝਾਉਂਦੇ ਮੈਂ ਅੱਠਵੀਂ ਵਿੱਚ ਨਿਊਟਰਸ ਬਾਰੇ ਪੜ੍ਹਿਆ ਹੈ ਜੋ ਕਿ ਸਾਡੀ ਜਿੰਦ ਜੇ ਕੋਈ ਸਾਡੇ ਲਈ ਬਹੁਤ ਜ਼ਰੂਰੀ ਹੈ ਮੈਂ ਸ਼ਰੀਰ ਵੀ ਜਿਹਦੇ ਨਾਲ ਅਸੀਂ ਤੁਰਦੇ ਹਾਂ ਉਹ ਵੀ ਵਿਗਿਆਨ ਨਾਲ ਹੀ ਤੁਰਦੇ ਹਾਂ ਅਤੇ ਗਣਿਤ ਵੀ ਬਹੁਤ ਵਧੀਆ ਟੀਚਰ ਪੜਾਉਂਦੇ ਆ ਅਤੇ ਮਤਲਬ ਅੱਜ ਕਲ੍ਹ ਜੋ ਕੋਈ ਚੀਜ਼ ਸ਼ਹਿਰੋਂ ਖਰੀਦਣ ਜਾਂਦੇ ਹਾਂ ਤਾਂ ਗਣਿਤ ਦੀ ਬਹੁਤ ਜੇ ਅਸੀਂ ਕੋਈ ਜ਼ਮੀਨ ਖਰੀਦਦੇ ਹਾਂ ਤਾਂ ਗਣਿਤ ਦੀ ਬਹੁਤ ਜ਼ਰੂਰੀ ਹੁੰਦੀ ਆ ਵਿਗਿਆਨ ਵਿੱਚ ਸਾਨੂੰ ਬਹੁਤ ਕੁਛ ਸ਼ਰੀਰ ਬਾਰੇ ਮਿਲਦਾ ਹੈ ਅਤੇ ਅੰਗਾਂ ਬਾਰੇ ਪਤਾ ਲੱਗਦਾ ਅਤੇ ਅੰਗਾਂ ਦੇ ਨਾਮ ਪਤਾ ਲੱਗਦੇ ਆ ਅਤੇ ਗਣਿਤ ਵਿੱਚ ਹਿਸਾਬ ਕੀਤਾ ਜਾਂਦਾ ਜਿਵੇਂ ਅਸੀਂ ਕੋਈ ਜ਼ਮੀਨ ਖਰੀਦੇ ਆ ਤਾਂ ਹਿਸਾਬ ਕਰਦੇ ਹਾਂ ਜੇ ਅਸੀਂ ਕੁਛ ਚੀਜ਼ ਮੰਡੀਓਂ ਦੁਕਾਨੋਂ ਖਰੀਦਦੇ ਹਾਂ ਤਾਂ ਗਣਿਤ ਦੀ ਬਹੁਤ ਜ਼ਿਆਦਾ ਮਤਲਵ ਜ਼ਰੂਰਤ ਹੈ ਅਤੇ ਗਣਿਤ ਕੋਈ ਚੀਜ਼ ਗ ਲੈਣੀ ਖਰੀਦਣੀ ਵੇਚਣੀ ਬਹੁਤ ਜ਼ਰੂਰੀ ਆ ਵਿਗਿਆਨ ਸਾਡੇ ਸ਼ਰੀਰ ਲਈ ਜ਼ਰੂਰੀ ਆ ਅਤੇ ਵਿਗਿਆਨ ਸਾਨੂੰ ਦੱਸਦਾ ਹੈ ਕਿ ਕੀ ਕੁਛ ਮਤਲਬ ਅਸੀਂ ਖਾਣਾ ਪੀਣਾ ਹੈ ਨਾ ਅੰਗਾਂ ਬਾਰੇ ਸਾਨੂੰ ਕੋਈ ਜਾਣਕਾਰੀ ਦਿੰਦਾ ਵਿਗਿਆਣ ਆ ਅਤੇ ਮੈਂ ਅਸੀਂ ਕੋਈ ਜ਼ਮੀਨ ਖਰੀਦਦੇ ਹਾਂ ਵੇਚਦੇ ਹਾਂ ਅਤੇ ਮਤਲਬ ਹਿਸਾਬ ਕਰਦੇ ਆ ਉਦੋਂ ਮੈਥ ਦੀ ਜ਼ਰੂਰਤ ਗਣਿਤ ਦੀ ਜ਼ਰੂਰਤ ਕੀਤੀ ਜਾਂਦੀ ਆ